ਮੈਂ ਐਮਾਜ਼ੋਨ ਤੋਂ ਬਿਆਲੀ ਇੰਚੀ ਵੀ ਯੂ ਟੀਵੀ ਤੀਹ ਹਜ਼ਾਰ 'ਚ ਮੰਗਵਾਇਆ ਲੋਕਾਂ ਦੇ ਰਿਵਿਊ ਦੇਖ ਕੇ ਮੈ ਇਹ ਫੈਸਲਾ ਕੀਤਾ ਸੀ ਪਰ ਸਾਡਾ ਟੀਵੀ ਵਧੀਆ ਨਹੀਂ ਨਿਕਲਿਆ ਕੁਝ ਹੀ ਦਿਨਾਂ ਬਾਅਦ ਇਸਦੀ ਆਵਾਜ਼ ਦੀ ਅਤੇ ਪਿਕਚਰ ਦੀ ਕੁਆਲਿਟੀ ਚੰਗੀ ਨਹੀਂ ਲੱਗੀ ਅਸੀਂ ਕੰਪਨੀ ਨੂੰ ਕੰਪਲੇਂਟ ਕੀਤੀ ਅਤੇ ਉਹਨਾਂ ਨੇ ਵਾਰੰਟੀ ਪੀਰੀਅਡ ਕਰਕੇ ਇਸਨੂੰ ਬਦਲ ਕੇ ਦਿੱਤਾ ਪਰ ਓਹ ਦੂਜਾ ਬਦਲਿਆ ਹੋਇਆ ਟੀਵੀ ਵੀ ਚੰਗਾ ਨਹੀਂ ਨਿਕਲਿਆ ਅਤੇ ਕੁਝ ਮਹੀਨਿਆਂ ਬਾਅਦ ਉਹਦਾ ਪੈਨਲ ਵੀ ਖਰਾਬ ਹੋ ਗਿਆ ਅਸੀਂ ਅੱਠ ਨੌ ਹਜ਼ਾਰ ਰੁਪਈਆ ਲਾ ਕੇ ਉਹਦਾ ਪੈਨਲ ਪਵਾਇਆ ਪਰ ਸਾਨੂੰ ਉਹ ਵੀ ਵਧੀਆ ਨਹੀਂ ਲੱਗਿਆ ਇਸ ਕਰਕੇ ਸਾਨੂੰ ਔਨਲਾਈਨ ਸ਼ੋਪਿੰਗ ਚਾਹੇ ਅਸੀਂ ਰਿਵਿਊ ਵੀ ਦੇਖੇ ਹੋਣ ਬਹੁਤ ਸੋਚ ਸਮਝ ਕੇ ਕਰਨੀ ਚਾਹੀਦੀ ਹੈ